ਜੀ ਮੈਂ ਨਾ ਬੁੱਕ ਆਰਡਰ ਕੀਤੀ ਸੀ ਫਰਿਕਸ਼ਨਲ ਬੁੱਕ ਹੈਰੀ ਪੋਟਰ ਦੀ ਉਹ ਬੁੱਕ ਇੰਨੀ ਚੰਗੀ ਹੈ ਨਾ ਮੈਂ ਕੀ ਕਵਾਂ ਤੂੰ ਤੁਹਾਨੂੰ ਉਹਦੀ ਇਮੈਜੀਨੇਸ਼ਨ ਅਤੇ ਉਹਨੂੰ ਲਿਖਣ ਦਾ ਸਲੀਕਾ ਅਤੇ ਪੈਕਿੰਗ ਵੀ ਕਾਫੀ ਚੰਗੀ ਸੀ ਮੈਂ ਆਰਡਰ ਕੀਤੀ ਸੀ ਅਤੇ ਮੈਨੂੰ ਆਰਡਰ ਵੀ ਟਾਈਮ 'ਤੇ ਮਿਲਿਆ ਮੇਰਾ ਉਹ ਐਕਸਪੀਰੀਐਂਸ ਬੜਾ ਯੂਨੀਕ ਕਹਿ ਸਕਦੇ ਹੋ ਮੈਨੂੰ ਬਹੁਤ ਚੰਗਾ ਲੱਗਿਆ ਕਿ ਇੰਨੀ ਚੰਗੀ ਬੁੱਕ ਮੈਨੂੰ ਔਨ ਦਾ ਟਾਈਮ ਮਿਲ ਗਈ ਅਤੇ ਮੈਂ ਪੜ੍ਹ ਵੀ ਲਿਆ ਅਤੇ ਕੁਝ ਕੁਝ ਪੁਆਇੰਟ ਮੈਨੂੰ ਉਹਨਾਂ ਦੇ ਬਹੁਤ ਚੰਗੇ ਲੱਗੇ ਅਤੇ ਡਿਲੀਵਰੀ ਚਾਰਜਿਸ ਵੀ ਸਾਰੇ ਅਫੋਰਡੇਬਲ ਸੀ ਅਤੇ ਹੋਰ ਵੀ ਬਹੁਤ ਕੁਝ ਹੈ ਫਰਿਕਸ਼ਨਲ ਬੁੱਕ ਇੱਕ ਬੁੱਕ ਨਹੀਂ ਇੱਕ ਇਮੋਸ਼ਨ ਹੈ ਮੈਨੂੰ ਤਾਂ ਇਹ ਲੱਗਿਆ ਪੜ੍ਹ ਕੇ ਅਤੇ ਜਿਨ੍ਹਾਂ ਤੋਂ ਜਿਸ ਸਾਈਟ ਤੋਂ ਮੈਂ ਆਰਡਰ ਕੀਤਾ ਸੀ ਉਹਨਾਂ ਦੀ ਸਰਵਿਸ ਵੀ ਮੈਨੂੰ ਬਹੁਤ ਚੰਗੀ ਲੱਗੀ ਜਿਸ ਟਾਈਮ ਤੋਂ ਉਹਨਾਂ ਨੇ ਬੋਲਿਆ ਸੀ ਉਹ ਟਾਈਮ ਤੋਂ ਕੁਝ ਸਮੇਂ ਪਹਿਲਾਂ ਮੈਨੂੰ ਮੇਰਾ ਆਰਡਰ ਮਿਲ ਗਿਆ ਸੀ ਥੈਂਕਯੂ